ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਤੁਹਾਨੂੰ ਕਹਿਣਾ ਸੀ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਤੋਂ ਬੋਲ ਰਹੀ ਹਾਂ ਹਾਂ ਅਤੇ ਮੈਂ ਅਮਨ ਛੋਟੀ ਸਿਸਟਰ ਹਾਂ ਅਤੇ ਮੈਮ ਮੈਂ ਕੀ ਕਹਿੰਦੇ ਆ ਪਲੱਸ ਟੂ ਮੇਰੀ ਕੰਪਲੀਟ ਹੋ ਗਈ ਆ ਅਤੇ ਮੈਂ ਮਤਲਬ ਕਿ ਅੱਗੇ ਬੀਕੌਮ ਕਰਨੀ ਆ ਹਾਂ ਅਤੇ ਪਲੱਸ ਟੂ ਮੈਂ ਕਾਮਰਸ ਵਿਚ ਕੀਤੀ ਆ ਅਤੇ ਮੈਨੂੰ ਤੁਸੀਂ ਦੱਸਿਓ ਕਿ ਪਠਾਨਕੋਟ 'ਚ ਕਿਹੜੇ ਵਧੀਆ ਜੀ ਕੋਲਜ ਆ ਹਾਂਜੀ

ਹਾਂਜੀ ਮੈਮ ਮੈਮ ਇਹਦੀ ਕਿੰਨੀ ਫੀਸ ਆ ਹਾਂਜੀ ਹਾਂਜੀ ਹਾਂਜੀ ਅੱਛਾ ਮੈਮ ਅਤੇ ਅਤੇ ਸਕੋਲਰਸ਼ਿਪ ਲੱਗਦੀ ਆ ਜੇ ਵਧੀਆ ਨੰਬਰ ਆਉਂਦੇ ਆ ਤਾਂ ਠੀਕ ਹੈ ਮੈਮ ਮੈਂ ਇੰਨੇ ਅੱਛਾ ਮੈਮ ਠੀਕ ਆ ਕੋਈ ਨਾ ਮੈਮ ਵਧੀਆ ਨਾ ਸਾਰਾ ਹਾਂ ਟੀਚਰਸ ਵਗੈਰਾ ਹਾਂ ਕੋਈ ਨਾ ਮੈਮ ਫਿਰ ਮੈਂ ਆ ਕੇ ਤੇ ਐਡਮਿਸ਼ਨ ਲਵਾਂਗੀ ਠੀਕ ਹੈ ਥੈਂਕ ਯੂ